ਹਾਂ ਇੱਕ ਸਾਡੇ ਇਤਿਹਾਸ ਬਾਰੇ ਸੁਣਿਆ ਅਤੇ ਬਾਬਿਓ ਇਤਿਹਾਸ ਅਤੇ ਉਹਨੇ ਨਾ ਆਪਣੇ ਮਤਲਬ ਕਿ ਮਗਰ ਭੋਲੇ ਭਾਲੇ ਲੋਕਾਂ ਨੂੰ ਮਾਗਰ ਲਾਇਆ ਹੋਇਆ ਸੀਗਾ ਅਤੇ ਉਹਨਾਂ ਨੂੰ ਗੁੰਮਰਾਹ ਵੀ ਕਰਦਾ ਸੀ ਅਤੇ ਉਹਨੇ ਇੱਕ ਆਪਣਾ ਕੋਈ ਅਸਥਾਨ ਵੀ ਬਣਾਇਆ ਸੀ ਉੱਥੇ ਸ਼ੋਸ਼ਣ ਵੀ ਕਰਦਾ ਸੀਗਾ ਅਤੇ ਭਾਵ ਉਹਨਾਂ ਨੂੰ ਗੁੰਮਰਾਹ ਕਰਕੇ ਵਸੂਲ ਕਰਦਾ ਸੀ ਪੈਸੇ ਲੁੱਟਦਾ ਵੀ ਸੀ ਬੜਾ ਕੁਝ ਕਰਦਾ ਸੀਗਾ ਇਹਦਾ ਟਕਰਾਅ ਵੀ ਹੋ ਗਿਆ ਸੀ ਟਕਰਾਅ ਇਸ ਗੱਲ ਨੂੰ ਹੋਇਆ ਸੀ ਕਿਉਂਕਿ ਜਿਹੜੇ ਉਸ ਬਾਬੇ ਕੋਲ ਲੋਕ ਸੀ ਨਾ ਉਹਦੇ ਜਿਹੜੇ ਚੇਲੇ ਸੀ ਉਹਨਾ ਨਾਲ ਟਕਰਾਅ ਇਸ ਕਰਕੇ ਹੋਇਆ ਸੀਗਾ ਕਿ ਵੀ ਇਹ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਪਿੱਛੇ ਲਾਉਂਦਾ ਅਤੇ ਜਿਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਪਿੱਛੇ ਲਾ ਕੇ ਅਤੇ ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਦੇ ਨਾਲ ਟਕਰਾਅ ਹੋ ਗਏ ਇਸ ਗੱਲ ਦਾ ਵੀ ਇਹ ਤੁਹਾਨੂੰ ਲੁੱਟਮਾਰ ਕਰਦਾ ਜਾਂ ਤੁਹਾਡਾ ਸ਼ੋਸ਼ਣ ਕਰਦਾ ਵੀ ਇਸ ਤੋਂ ਤੁਸੀਂ ਬਚੋ ਪਰ ਜਿਹੜੇ ਉਹਦੇ ਬਾਬੇ ਦੇ ਨਾਲ ਉਹ ਚੇਲੇ ਸੀ ਜਾਂ ਲੋਕ ਸੀ ਉਹ ਉਹਦੇ ਨਾਲ ਸਹਿਮਤ ਸੀ ਟਕਰਾਅ ਬੜੀ ਹੋਇਆ ਨਤੀਜਾ ਅਤੇ ਇਹ ਹੈ ਨਾ ਵੀ ਮਤਲਬ ਕਿ ਸਾਨੂੰ ਇਹੋ ਜਿਹੇ ਜਿਹੜੇ ਬਾਬੇ ਨੇ ਉਹਨਾਂ ਤੋਂ ਬਚਣਾ ਚਾਹੀਦਾ ਅਤੇ ਸਾਨੂੰ ਇਹਨਾਂ ਤੋਂ ਗੁੰਮਰਾਹ ਹੋਣ ਤੋਂ ਬਚਣਾ ਚਾਹੀਦਾ ਧੰਨਵਾਦ